ਮੈਂ ਜਿਆਦਾਤਰ ਹੱਕ ਹੈਗਾ ਵਾ ਆਨਲਾਈਨ ਮੀਟਿੰਗ ਦੇ ਵਿੱਚ ਕਿਉਂਕਿ ਇਹ ਸਭ ਤੋਂ ਵਧੀਆ ਚੀਜ਼ ਹੈ ਸਭ ਤੋਂ ਪਹਿਲੀ ਗੱਲ ਕੀ ਜੇ ਆਪਾਂ ਕਿਸੇ ਬੰਦੇ ਦੇ ਨਾਲ ਮੀਟਿੰਗ ਕਰਨੀ ਹ ਸਭ ਤੋਂ ਪਹਿਲਾਂ ਕੀ ਹ ਸਾਨੂੰ ਆਪਣੇ ਕਿਸੇ ਜਗ੍ਹਾ ਤੋਂ ਉੱਠ ਕੇ ਉਹਦੇ ਕੋਲ ਜਾਣਾ ਪੈਂਦਾ ਹੈ ਫਿਰ ਆਪਾਂ ਬਹਿਨੇ ਆਂ ਆਣ ਜਾਣ ਦਾ ਟਾਈਮ ਜਿਹੜਾ ਲੱਗਦਾ ਫਿਰ ਉਸ ਤੋਂ ਬਾਅਦ ਗੱਲ ਟਾਈਮ ਆ ਉਹ ਕਿੰਨਾ ਟਾਈਮ ਕੰਜਿਊਮ ਕਿੰਨਾ ਜਿਆਦਾ ਟਾਈਮ ਉਹਦੇ ਵਿੱਚ ਜਿਹੜਾ ਹੈ ਖਰਾਬ ਹੋ ਜਾਂਦਾ ਸੋ ਮੇਰੀ ਇਹ ਰਾਏ ਹੈ ਕਿ ਸਾਨੂੰ ਜਿਹੜਾ ਹੈ ਜਿਆਦਾ ਤੋਂ ਜਿਆਦਾ ਕੰਮ ਆਨਲਾਈਨ ਮੀਟਿੰਗ ਦੇ ਵਿੱਚ ਕਰਨਾ ਚਾਹੀਦਾ ਹੈ ਉਹਦੇ ਵਿੱਚ ਕੀ ਹੈ ਇੱਕ ਤਾਂ ਜਿਹੜਾ ਬੰਦਾ ਜਿਹੜਾ ਮੀਟਿੰਗ ਕਰਨ ਜਾ ਰਿਹਾ ਉਹਦਾ ਟਾਈਮ ਬਚਦਾ ਜਿਹਨੇ ਮੀਟਿੰਗ ਕਰਨੀ ਹ ਉਹਦਾ ਟਾਈਮ ਬਚਦਾ ਜਿਹੜਾ ਬਚਿਆ ਹੋਇਆ ਟਾਈਮ ਹੈ ਆਪਾਂ ਉਹਦੇ ਵਿੱਚ ਕੋਈ ਹੋਰ ਆਪਣਾ ਵਧੀਆ ਕੰਮ ਕਰ ਸਕਦੇ ਆ ਇਹਦੇ ਨਾਲ ਕੀ ਹੈਗਾ ਕਿ ਜਿਹੜਾ ਸਾਡਾ ਗੱਡੀ ਦਾ ਤੇਲ ਹੈ ਜਾਂ ਆਪਾਂ ਕਿਤੇ ਜਾਣਾ ਟਰੈਫਿਕ ਹੈ ਉਸ ਤੋਂ ਸਵ ਟੈਂਸ਼ਨ ਨਾ ਕਈ ਵਾਰੀ ਆਪਾਂ ਕਿਤੇ ਜਾਣਾ ਹੁੰਦਾ ਕਈ ਵਾਰੀ ਅੱਜ ਕੱਲ ਟਰੈਫਿਕ ਨੇ ਜਿਆਦਾ ਉਸ ਵਿੱਚ ਐਕਸੀਡੈਂਟ ਵੀ ਹੋ ਜਾਂਦਾ ਉਹ ਸਾਰੀ ਚੀਜ਼ਾ ਤੋਂ ਬਚਾਅ ਹੁੰਦਾ ਹੈ ਤੇ ਆਨਲਾਈਨ ਮੀਟਿੰਗ ਦੇ ਵਿੱਚ ਆਹ ਵੀ ਫਾਇਦਾ ਹੁੰਦਾ ਹੈ ਕਿ ਆਪਾਂ ਆਪਣੇ ਕਮ ਸਕੂਨ ਦੇ ਵਿੱਚ ਆਰਾਮ ਨਾਲ ਆਪਣੇ ਘਰੇ ਬਹਿ ਕੇ ਸ਼ਾਂਤ ਵਾਤਾਵਰਨ ਦੇ ਵਿੱਚ ਬਹਿ ਕੇ ਗੱਲ ਕਰ ਸਕਦੇ ਆ ਕਿ ਦੂਜੇ ਦੇ ਨਾਲ ਤੇ ਉੱਥੇ ਕੋਈ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਹੈ ਆਪਣਾ ਸਿਰਫ ਤੁਹਾਨੂੰ ਉਹਦੇ ਵਿੱਚ ਇਹੀ ਹੈ ਕਿ ਤੁਹਾਨੂੰ ਸਿਰਫ ਆਪਣਾ ਜਿਹੜਾ ਇੰਟਰਨੈਟ ਹੈ ਜਿਹਦੇ ਵਿੱਚ ਥਰੂ ਤੁਸੀਂ ਕਾਲ ਕਰ ਰਹੇ ਹੋ ਉਹ ਉਹਦਾ ਇੰਟਰਨੈਸ਼ਨਲ ਮਜਬੂਤ ਹੋਣਾ ਚਾਹੀਦਾ ਹੈ ਸੋ ਮੈਂ ਆਹੀ ਸੋਚਦਾ ਹਾਂ ਕਿ ਆਨਲਾਈਨ ਮੀਟਿੰਗ ਦੇ ਵਿੱਚ ਮੀਟਿੰਗ ਕਰਨਾ ਤੇ ਜਿੱਦਾਂ ਕਿ ਬਥੇਰੇ ਐਪਸ ਹੈਗੇ ਆ ਜਿਦਾਂ ਗੂਗਲ ਮੀਟਿੰਗਜ਼ ਜੂਮ ਆਪਾਂ ਉਹਨਾਂ ਦੇ ਵਿੱਚ ਜੋਇਨ ਕਰਕੇ ਆਪਾਂ ਆਪਣੀ ਮੀਟਿੰਗ ਕਰ ਸਕਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੂਰੇ ਕਰੋਨਾ ਕਾਲ ਦੇ ਵਿੱਚ ਆਪਾਂ ਸਾਰੇ ਜਾਨੇ ਜਿਨਾਂ ਦੇ ਵੀ ਆਈਟੀ ਦੀ ਜੋਬ ਸੀ ਜਾਂ ਸਕੂਲ ਦੇ ਜਿਹੜੇ ਬੱਚੇ ਸੀ ਉਹ ਜਿਹੜਾ ਹੈਗੇ ਆ ਸਿਰਫ ਤੇ ਸਿਰਫ ਆਨਲਾਈਨ ਮੀਟਿੰਗਾਂ ਦੇ ਰਾਹੀ ਹੀ ਪੜ ਰਹੇ ਸੀ ਜਿਹੜਾ ਕਿ ਬਹੁਤ ਚੰਗਾ ਇੱਕ ਤੁਸੀਂ ਕਹਿ ਲਓ ਚੰਗਾ ਵਿਸ਼ਾ ਸੀਗਾ ਕਿ ਜਿਹਦੇ ਕਰਕੇ ਬੱਚਿਆਂ ਦਾ ਭਵਿਸ਼ਆ ਖਰਾਬ ਹੋਣ ਤੋਂ ਬਚ ਗਿਆ